ਮੇਰਾ ਨਾਮ ਰਮਨਦੀਪ ਕੌਰ ਹੈ ਮੈਂ ਬਠਿੰਡਾ ਦੇ ਰਾਮ ਜੀ ਨਗਰ 'ਚ ਰਹਿੰਦੀ ਹਾਂ ਮੈਂ ਚੰਡੀਗੜ੍ਹ ਜਾਣ ਲਈ ਇੱਕ ਚੌਵੀ ਛੇ ਦੋ ਹਜ਼ਾਰ ਚੌਵੀ ਤਰੀਕ ਲਈ ਕੈਬ ਬੁੱਕ ਕਰਵਾਉਣੀ ਹੈ ਜੋ ਕਿ ਮੈਨੂੰ ਸਵੇਰੇ ਸੁਬਹਾ ਛੇ ਵਜੇ ਚਾਹੀਦੀ ਹੈ ਅਤੇ ਇਹਦੇ ਵਿੱਚ ਮੈਂ ਬਠਿੰਡੇ ਤੋਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਣਾ ਮੈਂ ਆਪਦੇ ਸਰਟੀਫਿਕੇਟ ਲੈਣ ਜਿਹਦੇ ਵਿੱਚ ਮੈਂ ਮੈਂ ਉਸੇ ਕੈਬ 'ਤੇ ਵਾਪਸ ਆਉਣਾ ਉਹਦੇ ਲਈ ਮੈਂ ਕੈਬ ਬੁੱਕ ਕਰਵਾ ਰਹੀ